ਹੈਲੋ ਹਾਂਜੀ ਬਾਈ ਜੀ ਜੋਗੇ ਤੋਂ ਬੋਲਦੇ ਹੋ ਬਾਈ ਜੀ ਮੈਂ ਬਲਜਿੰਦਰ ਬਾਵਾ ਬੋਲਦਾ ਪੱਤਰਕਾਰ ਮੀਡੀਆ ਤੋਂ ਅੱਛਾ ਵੀਰ ਜੀ ਇੱਕ ਜਾਣਕਾਰੀ ਲੈਣੀ ਆ ਤੁਹਾਡੇ ਤੋਂ ਤੁਹਾਡੇ ਪਿੰਡ ਦੀ ਜੀ ਤੁਹਾਡੇ ਪਿੰਡ ਦੇ ਵਿੱਚ ਸਕੂਲ ਕਿੰਨੇ ਨੇ ਸਰਕਾਰੀ ਅਤੇ ਆਪਣੇ ਕਿਵੇਂ ਆ ਪੜ੍ਹਾਈ ਪੜੂਈ ਦਾ ਬੱਚਿਆਂ ਦਾ ਅੱਛਾ ਟੀਚਰ ਵਧੀਆ ਨੇ ਸਟਾਫ ਪੂਰਾ ਹੈਗਾ ਅੱਛਾ ਬੱਚੇ ਕਿੰਨੇ ਕਿੰਨੇ ਹੈਗੇ ਸਕੂਲਾਂ 'ਚ ਅੱਛਾ ਅੱਛਾ ਠੀਕ ਹੈ ਠੀਕ ਹੈ ਅਤੇ ਬੱਚੇ ਵਧੀਆ ਆਉਂਦੇ ਆ ਟਾਇਮ ਟੂਮ 'ਤੇ ਕੋਈ ਲੇਟ ਫੇਟ ਜਾਂ ਕੋਈ ਟੀਚਰ ਕਿਵੇਂ ਚਲਦੀ ਆ ਪੜ੍ਹਾਈ ਪੜੂਈ ਬਾਰੇ ਦੱਸਿਓ ਸਾਨੂੰ ਮਾੜਾ ਜਿਹਾ ਅੱਛਾ ਅੱਛਾ ਅਤੇ ਆਪਣਾ ਕੋਈ ਹੋਰ ਕੋਈ ਘਾਟ ਵਾਧ ਸਕੂਲ ਦੇ ਵਿੱਚ ਪਾਣੀ ਦੀ ਜਾਂ ਕੋਈ ਹੋਰ ਆਪਣੇ ਅ ਮਿੱਡੇ ਮੀਲ ਚੱਲਦੇ ਆ ਸਕੂਲਾਂ ਦੇ ਵਿੱਚ

ਅੱਛਾ ਅੱਛਾ ਅੱਛਾ ਅੱਛਾ ਅੱਛਾ ਅਤੇ ਆਪਣਾ ਬੱਚਿਆਂ ਦੀ ਪੜ੍ਹਾਈ ਦਾ ਹੀ ਪੁੱਛਣਾ ਸੀ ਵੀ ਤੁਹਾਡੇ ਬੱਚਿਆਂ ਦੀ ਪੜ੍ਹਾਈ ਸਹੀ ਚੱਲ ਰਹੀ ਹੈ ਅੱਛਾ ਅੱਛਾ ਖੇਡਾਂ ਤਾਂ ਫਿਲਹਾਲ ਹੋਣ ਹੋਣੀ ਆ ਇਹ ਤੋਂ ਬਾਅਦ ਮੇਰੇ ਖਿਆਲ ਸ਼ਾਇਦ ਦੀਆਂ ਹਾਂਜੀ ਹਾਂਜੀ ਅਤੇ ਇੱਕ ਆਪਣੇ ਭਲਾ ਕੋਈ ਆਪਣੇ ਪੋਸਟਾਂ ਸਾਰੀਆਂ ਪੂਰੀਆਂ ਨੇ ਸਕੂਲ ਦੇ ਵਿੱਚ ਅੱਛਾ ਅੱਛਾ ਅੱਛਾ ਹੋਰ ਕੋਈ ਆਪਣੇ ਸ਼ਿਕਾਇਤ ਕਿਸੇ ਦੀ ਹੁੰਦੀ ਹੈ ਕਈ ਵਾਰੀ ਤਾਂ ਸਾਨੂੰ ਦੱਸਣਾ ਤੁਸੀਂ ਅੱਛਾ ਅੱਛਾ ਇੱਕ ਨਾ ਇੱਥੇ ਕਮੇਟੀਆਂ ਬਣੀਆਂ ਹੁੰਦੀਆਂ ਆਪਾਂ ਆਪਣੇ ਪਿੰਡ ਪੱਧਰ ਦੀਆਂ ਬੱਚਿਆਂ ਦੇ ਮਾਪਿਆਂ 'ਚੋਂ ਬਣੀਆਂ ਹੁੰਦੀਆਂ ਉਹ ਪ ਆਪਣੇ ਕਮੇਟੀਆਂ ਦੇ ਕ ਆਉਂਦੇ ਜਾਂਦੇ ਵਧੀਆ ਕੰਮ ਧੰਦਾ ਕਰਦੇ ਹੈ ਠੀਕ ਹੈ ਚਲੋ ਠੀਕ ਆ ਵੀਰ ਜੀ ਇਹੀ ਜਾਣਕਾਰੀ ਲੈਣੀ ਸੀ ਤੁਹਾਡੇ ਤੋਂ ਧੰਨਵਾਦ ਤੁਹਾਡਾ